ਸੌਲ੍ਹਾਂ ਜੁਲਾਈ ਉੱਨੀ ਸੌ ਸਤਾਸੀ ਚਾਰ ਅਗਸਤ ਉੱਨੀ ਸੌ ਬਾਨਵੇਂ ਅੱਠ ਫਰਵਰੀ ਉੱਨੀ ਸੌ ਅਠਾਨਵੇਂ ਛੇ ਮਾਰਚ ਦੋ ਹਜ਼ਾਰ ਵੀਹ ਨੌਂ ਅਗਸਤ ਦੋ ਹਜ਼ਾਰ ਸਤਾਰ੍ਹਾਂ